ਹਾਂਜੀ ਮੈਂ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਸਿੱਖੀਆਂ ਹਨ ਕੁਛ ਉਪਭਾਸ਼ਾਵਾਂ ਹਨ ਮਾਝੀ ਦੁਆਬੀ ਮਲਵਈ ਡੋਗਰੀ ਪੁਆਧੀ ਪੋਠੋਹਾਰੀ ਮੁਲਤਾਨੀ ਭਟਿਆਲੀ ਜਿਹੜੀ ਉਪਭਾਸ਼ਾ ਮੈਂ ਜ਼ਿਆਦਾਤਰ ਬੋਲੀ ਹੈ ਉਹ ਮਾਝੇ ਦੇ ਇਲਾਕੇ 'ਚ ਬੋਲੀ ਹੈ ਮੇਰਾ ਪਿਛੋਕੜ ਅੰਮ੍ਰਿਤਸਰ ਦਾ ਹੋਣ ਕਰਕੇ ਇਹ ਜਿਹੜੀ ਭਾਸ਼ਾ ਹੈ ਗੁਰਦਾਸਪੁਰ ਅੰਮ੍ਰਿਤਸਰ ਵਿੱਚ ਬੋਲੀ ਜਾਂਦੀ ਹੈ ਇੱਥੇ ਜਿਹੜੇ ਮਾਝੇ ਦੇ ਲੋਕ ਨੇ ਇਹਨਾਂ ਲੋਕਾਂ ਨੂੰ ਹੀ ਮਾਝੇ ਦੇ ਲੋਕ ਕਿਹਾ ਜਾਂਦਾ ਹੈ ਅਤੇ ਇਹਨਾਂ ਦੀ ਜਿਹੜੀ ਭਾਸ਼ਾ ਬੋਲਣ ਦੀ ਜਿਹੜਾ ਤਰੀਕਾ ਹੈ ਉਹ ਬਾਕੀ ਜਿਹੜੇ ਤਰੀਕੇ ਨੇ ਉਹਨਾਂ ਦੇ ਨਾਲੋਂ ਥੋੜ੍ਹਾ ਅੱਡ ਹੈ ਇਸ ਨੂੰ ਟਕਸਾਲੀ ਜਾਂ ਕੇਂਦਰੀ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਵੀ ਕਿਹਾ ਜਾਂਦਾ ਹੈ ਇਸ ਬੋਲੀ ਦੇ ਵਿੱਚ ਪੰਜਾਬੀ ਦੀ ਵਿਸ਼ੇਸ਼ ਧੁਨੀ ਰਾੜਾ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਅਤੇ ਇਸ ਕਰਕੇ ਇਹ ਭਾਸ਼ਾ ਦੇ ਬਾਰੇ 'ਚ ਮੈਨੂੰ ਥੋੜ੍ਹਾ ਗਿਆਨ ਹੈ